ਲੋਕਡਾਊਨ ਦੇ ਵਿੱਚ ਸਰਕਾਰ ਨੇ ਸਾਰਿਆਂ ਨੂੰ ਆਪਣੇ ਆਪਣੇ ਘਰ ਰਹਿਣ ਦੀ ਸਲਾਹ ਦਿੱਤੀ ਸੀ ਜਿਸ ਦਾ ਸਰਕਾਰ ਵੱਲੋਂ ਸਖ਼ਤਾਈ ਨਾਲ ਪਾਲਣ ਵੀ ਕਰਵਾਇਆ ਗਿਆ ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਕਰੋਨਾ ਵਾਇਰਸ ਨਾਮਕ ਮਹਾਂਮਾਰੀ ਮਾਨਵ ਜਾਤੀ 'ਤੇ ਇਤਿਹਾਸ ਵਿੱਚ ਪਹਿਲੀ ਵਾਰ ਆਈ ਪੂਰਾ ਦੇਸ਼ ਇਸ ਵਾਇਰਸ ਨਾਲ ਲੜਨ ਲਈ ਆਪਣੇ ਆਪਣੇ ਘਰਾਂ ਵਿੱਚ ਕੈਦ ਸੀ ਇਹ ਮਹਾਂਮਾਰੀ ਦਾ ਪ੍ਰਕੋਪ ਲੱਖਾਂ ਲੋਕਾਂ ਦੇ ਉੱਪਰ ਪੈ ਗਿਆ ਸੀ ਜਦੋਂ ਲੋਕਡਾਊਨ ਸ਼ੁਰੂ ਹੋਇਆ ਸੀ ਤਾਂ ਉਦੋਂ ਜਿਹੜੇ ਵੀ ਕੋਲਜ ਜਾਂ ਸਕੂਲ ਸੀ ਉਹਨਾਂ ਨੇ ਸਾਰਿਆਂ ਨੇ ਆਪਣੀ ਜਿਹੜੀ ਪੜ੍ਹਾਈ ਸੀ ਉਹ ਔਨਲਾਈਨ ਕਰਤੀ ਸੀ ਅਤੇ ਸਾਰੇ ਬੱਚੇ ਆਪਣੀ ਪੜ੍ਹਾਈ ਮੋਬਾਈਲ ਜਾਂ ਲੈਪਟੋਪ ਦੇ ਨਾਲ ਕਰ ਰਹੇ ਸੀ ਉਹਦੇ ਕਾਰਨ ਲੋਕ ਕਾਫੀ ਅਡਿਕਟਿਡ ਹੋ ਗਏ ਸੀ ਮੋਬਾਇਲ ਅਤੇ ਲੈਪਟੋਪ ਦੇ ਨਾਲ ਅਤੇ ਉਹਨਾਂ ਨੇ ਇਹਦੀ ਵਰਤੋਂ ਜ਼ਿਆਦਾ ਕਰਤੀ ਸੀ ਔਨਲਾਈਨ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਸਮਝਣ ਦੇ ਵਿੱਚ ਕਾਫੀ ਦਿੱਕਤ ਆਈ ਕਿਉਂਕਿ ਕਈ ਵਾਰੀ ਲਾਈਟ ਦੀ ਪ੍ਰੋਬਲਮ ਆ ਜਾਂਦੀ ਸੀ ਜਾਂ ਨੈੱਟ ਦੀ ਦਿੱਕਤ ਆ ਜਾਂਦੀ ਸੀ ਜਦੋਂ ਵੀ ਲਾਈਟ ਜਾਂਦੀ ਸੀ ਤਾਂ ਨੈਟ ਬੰਦ ਹੋ ਜਾਂਦਾ ਸੀ ਅਤੇ ਕਈ ਵਾਰੀ ਇਹ ਪ੍ਰੋਬਲਮ ਵੀ ਆਉਂਦੀ ਸੀ ਵੀ ਜਿਹੜੇ ਮੋਬਾਇਲ ਜਾਂ ਲੈਪਟੋਪ ਹੈ ਉਹਦੀ ਚਾਰਜਿੰਗ ਖਤਮ ਹੋ ਜਾਂਦੀ ਸੀ ਅਤੇ ਕਈ ਵਾਰੀ ਜਿਹੜੇ ਅਧਿਆਪਕ ਸੀ ਉਹਨਾਂ ਨੂੰ ਵੀ ਦਿੱਕਤ ਆਉਂਦੀ ਸੀ ਕਿਉਂਕਿ ਉਹ ਸਾਰੇ ਬੱਚੇ ਨਹੀਂ ਦੇਖ ਸਕਦੇ ਸੀ ਪੜ੍ਹਨ ਵਸ ਪੜ੍ਹਾਉਣ ਵਾਸਤੇ ਟੀਚਰਸ ਨੇ ਜਾਂ ਅਧਿਆਪਕਾਂ ਨੇ ਗੂਗਲ ਮੀਟ ਦੀ ਵਰਤੋਂ ਕੀਤੀ ਸੀ ਗੂਗਲ ਮੀਟ ਦੇ ਨਾਲ ਉਹਨਾਂ ਨੇ ਸਾਰੇ ਬੱਚਿਆਂ ਨੂੰ ਲਿੰਕ ਭੇਜਿਆ ਅਤੇ ਜੋ ਜੋ ਵੀ ਬੱਚੇ ਕਲਾਸ ਵਿੱਚ ਹੁੰਦੇ ਸੀ ਉਹ ਸਾਰੇ ਉਸ ਲਿੰਕ ਨੂੰ ਜੁਆਇਨ ਕਰਦੇ ਸੀ ਅਤੇ ਉਸਦੇ ਨਾਲ ਵੀਡੀਓ ਚੈਟ ਰਾਹੀਂ ਪੜ੍ਹਾਈ ਕੀਤੀ ਜਾਂਦੀ ਸੀ ਪਰ ਉਹਦੇ ਨਾਲ ਕਈ ਵਾਰੀ ਕੰਮ ਪੂਰਾ ਨਹੀਂ ਹੋ ਸ ਹੋ ਪਾਉਂਦਾ ਸੀ ਕਿਉਂਕਿ ਗੂਗਲ ਮੀਟ ਦੇ ਅੰਦਰ ਕਨੈਕਸ਼ਨ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਜਦੋਂ ਬੱਚੇ ਮੋਬਾਇਲ ਜਾਂ ਲੈਪਟੋਪ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦੇ ਸੀ ਤਾਂ ਫਿਰ ਉਹ ਕਈ ਵਾਰੀ ਨਾਲ ਨਾਲ ਖੇਡਾਂ ਖੇਡਣ ਲੱਗ ਜਾਂਦੇ ਸੀ ਅਤੇ ਟੀਚਰ ਨੂੰ ਪਤਾ ਨਹੀਂ ਲੱਗਦਾ ਸੀ ਵੀ ਬੱਚੇ ਸ ਪੜ੍ਹ ਵੀ ਰਹੇ ਨੇ ਜਾਂ ਨਹੀਂ ਖੇਡਾਂ ਦੇ ਕਾਰਨ ਬੱਚਿਆਂ ਨੇ ਪੜ੍ਹਾਈ ਵਿੱਚੋਂ ਮਨ ਹਟਾ ਲਿਆ ਜਿਹਦੇ ਕਰਕੇ ਉਹਨਾਂ ਨੂੰ ਕਈ ਵਾਰੀ ਜਿਹੜੇ ਟੋਪਿਕਸ ਸੀਗੇ ਉਹ ਸਮਝ ਨਹੀਂ ਆਉਂਦੇ ਸੀ ਸਕੂਲਿੰਗ ਜਾਂ ਘਰ ਤੋਂ ਕੰਮ ਕਰਨ ਦਾ ਤਜ਼ਰਬਾ ਬਾਕੀ ਲੋਕਾਂ ਦਾ ਠੀਕ ਹੀ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜਿਹੜੇ ਬੱਚੇ ਸਕੂਲ਼ ਵਿੱਚ ਜਾ ਕੇ ਪੜ੍ਹਾਈ ਕਰਦੇ ਨੇ ਉਹ ਪੜ੍ਹਾਈ ਜ਼ਿਆਦਾ ਵਧੀਆ ਹੁੰਦੀ ਹੈ ਨਾ ਕਿ ਜਿਹੜੀ ਕਿ ਮੋਬਾਈਲ ਜਾਂ ਲੈਪਟੋਪ ਦੇ ਰਾਹੀਂ ਕੀਤੀ ਜਾ ਸਕਦੀ ਹੈ ਜਿਹੜੇ ਅਧਿਆਪਕ ਸੀ ਉਹਨਾਂ ਨੂੰ ਲੱਗਿਆ ਵੀ ਮੋਬਾਇਲ ਜਾਂ ਲੈਪਟੋਪ ਰਾਹੀਂ ਜੋ ਵੀ ਪੜ੍ਹਾਈ ਕੀਤੀ ਗਈ ਹੈ ਉਸ ਦਾ ਬੱਚਿਆਂ ਦੇ ਉੱਪਰ ਕੋਈ ਅਸਰ ਨਹੀਂ ਹੋਇਆ ਬੱਚਿਆਂ ਨੂੰ ਕਿਤਾਬਾਂ ਦੀ ਲੋੜ ਨਹੀਂ ਪਈ ਪਰ ਲੈਪਟੋਪ ਜਾਂ ਮੋਬਾਈਲ ਹਰ ਕ ਹਰ ਬੱਚੇ ਕੋਲ ਨਹੀਂ ਸੀ ਤਾਂ ਫਿਰ ਕਈ ਲੋਕਾਂ ਨੂੰ ਮੋਬਾਈਲ ਜਾਂ ਲੈਪਟੋਪ ਖਰੀਦਣ ਦੀ ਲੋੜ ਪਈ ਜੋ ਕਿ ਕਾਫੀ ਜ਼ਿਆਦਾ ਮਹਿੰਗੇ ਸਨ ਲੋਕਾਂ ਨੂੰ ਲੱਗਾ ਵੀ ਮੋਬਾਇਲ ਲੈਪਟੋਪ ਲੈਣ ਦੇ ਨਾਲ ਉਹਨਾਂ ਦਾ ਨੁਕਸਾਨ ਹੀ ਹੋਏਗਾ ਕਿਉਂਕਿ ਬੱਚੇ ਸ਼ਾਇਦ ਉਸਦੇ ਨਾਲ ਸਿਰਫ ਪੜ੍ਹਾਈ ਨਾ ਕਰਕੇ ਖੇਡਾਂ ਖੇਡਣ ਲੱਗ ਜਾਣਗੇ ਅਧਿਆਪਕਾਂ ਨੂੰ ਇਹ ਲੱਗਿਆ ਵੀ ਜੇ ਬੱਚੇ ਕਿਤਾਬਾਂ ਰਾਹੀਂ ਪੜ੍ਹਨਗੇ ਤਾਂ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੋਏਗਾ